ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਠੀਕ ਹੈ ਹਾਂਜੀ ਅਸੀਂ ਵੀ ਠੀਕ ਹੈ ਤੁਸੀਂ ਸੁਣਾਓ ਫਿਰ ਕੀ ਹਾਲ ਚਾਲ ਬੱਚਿਆਂ ਦਾ ਪ੍ਰੋਗਰਾਮ ਹੈ ਹਾਂਜੀ ਦੱਸੋ ਹਾਂਜੀ ਸਰਕਾਰ ਗੁਰਦਾਸਪੁਰ ਤਾਂ ਲਿਟਲ ਫਲਾਵਰ ਪਾ ਲਓ ਅਸੀਂ ਵੀ ਲਿਟਲ ਫਲਾਵਰ ਹੀ ਆਪਣਾ ਪੋਤਰਾ ਪਾਇਆ ਵਾ ਹੈ ਅਤੇ ਮਹਿੰਗਾ ਹੀ ਹੈ ਚਲ ਚਲ ਲਿਟਲ ਫਲਾਵਰ ਹੀ ਪਾ ਛੱਡਿਆ ਗਾ ਭੈਣ ਜੀ ਚਲੋ ਚੰਗੇ ਸਕੂਲੇ ਬੱਚਾ ਪਾਉਣਾ ਚਾਹੀਦਾ ਕੱਲ੍ਹ ਨੂੰ ਚਲੋ ਬੱਚਾ ਕੁਛ ਚੰਗੇ ਨੰਬਰ ਲੈ ਆਏ ਅਤੇ ਚੰਗਾ ਵਧੀਆ ਪੜ੍ਹੇ ਅਤੇ ਹੋਣਾ ਚਾਹੀਦਾ ਹੈ ਹੋਰ ਤੁਸੀਂ ਦੇਖੋ ਹੋਰ ਹਾਂਜੀ ਉੱਥੇ ਚਲੋ ਫੀਸ ਉੱਥੇ ਕਾਫ਼ੀ ਹੈ ਭੈਣ ਜੀ ਤੁਸੀਂ ਰੈਡ ਰੋਜ ਪਾ ਲਓ ਉੱਥੇ ਫੀਸ ਘੱਟ ਜੇ ਉੱਥੇ ਤਾਂ ਬਹੁਤ ਘੱਟ ਜੇ ਫੀਸ ਉੱਥੇ ਚਲੋ ਬੱਚੇ ਨੂੰ ਪਹਿਲੇ ਪਲੇਅ ਵੇਅ ਪਾ ਲਓ ਥੋੜ੍ਹਾ ਜਿਹਾ ਫ਼ਾਇਦਾ ਹੁੰਦਾ ਮਾਂ ਪਿਓ ਨੂੰ ਚਲ ਬੱਚਾ ਹੀ ਘਰੋਂ ਚਲੇ ਜਾਂਦਾ ਇੰਨਾ ਹੀ ਬਹੁਤ ਜੇ ਵੀ ਬੱਚਾ ਘਰੋਂ ਚਲ ਜਾਂਦਾ ਮਾਂ ਪੇਰੈਂਟਸ ਨੂੰ ਇੰਨਾ ਹੀ ਹੋ ਜਾਂਦਾ ਬੱਚਾ ਬੈਣ ਖਲੋਣਾ ਸਿੱਖ ਜਾਂਦਾ ਭੈਣ ਜੀ ਨਹੀਂ ਭੈਣ ਜੀ ਟ੍ਰਾਂਸਪੋਰਟ ਦੀ ਤਾਂ ਨਹੀਂ ਅਤੇ ਚਲੋ ਅਜੇ ਤਾਂ ਆਪ ਹੀ ਮਿਹਨਤ ਕਰਨੀ ਪੈਣੀ ਜੇ ਆਪ ਹੀ ਛੱਡਣ ਜਾਣਾ ਪੈਣਾ ਜੇ ਉੱਥੇ ਜੇ ਨਹੀਂ ਜੇ ਹੈਗੀ ਅਤੇ ਫਿਰ ਚਲੋ ਕੋਈ ਹੋਰ ਸਕੂਲ ਦੇਖਣੇ ਇੱਥੇ ਐੱਚ ਆਰ ਹੈਗੀ ਜੇ ਫਸਲਿਟੀ ਉੱਥੇ ਪਾ ਲਈਓ ਜੇ ਬਹੁਤੀ ਗੱਲ ਹੈ ਤਾਂ ਹਾਂ ਹਾਂਜੀ ਉਹ ਵੀ ਬਹੁਤ ਵਧੀਆ ਸਕੂਲ ਜੇ ਉੱਥੇ ਹੀ ਪਾ ਲਓ ਤੁਸੀਂ ਫੀਸ ਵੀ ਹਿਸਾਬ ਦੀ ਜੇ ਫੀਸ ਆਹੋ ਭੈਣ ਜੀ ਕੋਈ ਨਹੀਂ ਫੀਸ ਹਿਸਾਬ ਦੀ ਹੈ ਉੱਥੇ ਇੰਨੀ ਜ਼ਿਆਦਾ ਫੀਸ ਨਹੀਂ ਹੈਗੀ ਤੁਸੀਂ ਉੱਥੇ ਬੱਚਾ ਪਾ ਲਓ ਚੰਗੇ ਰਹੋਗੇ ਕੋਈ ਗੱਲ ਹਾਂਜੀ ਗੇਮਸ ਵਗੈਰਾ ਹੈ ਬੱਚਿਆਂ ਨੇ ਬੁਹਤ ਫਸਿਲਟੀਆਂ ਭੈਣ ਜੀ ਅਸੀਂ ਵੇ ਸਾਡੇ ਬੱਚੇ ਵਧੀਆ ਗੇਮ ਕਰਦੇ ਜੇ ਸਾਡੇ ਬੱਚੇ ਗੇਮ ਤਾਂ ਅਸੀਂ ਵੈਸੇ ਹੀ ਸਲੈਕਟ ਕੀਤੇ ਨੇ ਕਈ ਬੱਚੇ ਹਾਂ ਠੀਕ ਹੈ ਓਕੇ ਜੀ ਬਾਏ